ਮੇਰਾ ਖੇਤਰ ਮਾਲਵਾ ਹੈ ਬਠਿੰਡਾ ਚੋਂ ਅਤੇ ਜੇ ਮੈਂ ਇੱਥੇ ਦੇਖਾ ਤਾਂ ਧਾਰਮਿਕ ਛੁੱਟੀਆਂ ਲੋਕ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ ਜਿਵੇਂ ਧਾਰਮਿਕ ਛੁੱਟੀਆਂ ਹੋਲੀ ਦੀ ਆਉਂਦੀ ਹੈ ਦਿਵਾਲੀ ਦੀ ਆਉਂਦੀ ਹੈ ਗੁਰਪੁਰਬ ਦੀ ਆਉਂਦੀ ਹੈ ਤਾਂ ਸਾਨੂੰ ਈਦ ਦੀ ਵੀ ਆਉਂਦੀ ਹੈ ਇੱਥੇ ਮੁਸਲਮਾਨ ਵੀ ਬੜੇ ਰਹਿੰਦੇ ਹਨ ਤਾਂ ਸਾਡੀ ਧਾਰਮਿਕ ਛੁੱਟੀਆਂ ਬੜੇ ਉਤਸ਼ਾਹ ਨਾਲ ਮਨਾਈਆਂ ਜਾਂਦੀਆਂ ਹਨ ਜੇ ਹੋਲੀ ਦੀ ਗੱਲ ਕਰੀਏ ਤਾਂ ਲੋਕ ਰੰਗ ਖੇਡ ਕੇ ਖਾ ਪੀ ਕੇ ਬੜਾ ਹੀ ਵਧੀਆ ਹੋਲੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਜੇ ਦਿਵਾਲੀ ਦੀ ਗੱਲ ਕਰਾਂ ਤਾਂ ਲੋਕ ਇਸ ਦਿਨ ਪਟਾਕੇ ਬੜੇ ਚਲਾਉਂਦੇ ਹੈ ਲੰਗਰ ਲੱਗਦੇ ਹੈ ਅਤੇ ਲੋਕ ਆਪਣੇ ਘਰਾਂ ਨੂੰ ਡੈਕੋਰੇਟ ਕਰਦੇ ਹੈ ਬੜਾ ਸਜਾਉਂਦੇ ਹਨ ਅਤੇ ਦੀਵੇ ਬਾਲਦੇ ਹਨ ਇਸ ਦਿਨ ਮੋਮਬੱਤੀਆਂ ਜਲਦੀਆਂ ਹਨ ਲਾਈਟਾਂ ਲਾ ਲਾ ਕੇ ਲੋਕ ਬੜਾ ਹੀ ਵਧੀਆ ਦਿਵਾਲੀ ਦਾ ਤਿਉਹਾਰ ਮਨਾਉਂਦੇ ਹਨ ਦਿਵਾਲੀ ਦੀਆਂ ਤਿਆਰੀਆਂ ਤਾਂ ਦੋ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਲੋਕ ਇੱਕ ਦੂਜੇ ਨੂੰ ਗਿਫਟਸ ਪ੍ਰਦਾਨ ਕਰਦੇ ਹੈ ਅਤੇ ਬਹੁਤ ਵਧੀਆ ਮਨਾਈ ਜਾਂਦੀ ਹੈ ਅਤੇ ਜੇ ਗੁਰਪੁਰਬ ਦੀ ਗੱਲ ਕਰੀਏ ਜਿਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਅਤੇ ਇੱਕ ਹੋਰ ਗੁਰਪੁਰਬ ਦਸੰਬਰ ਜਾਂ ਜਨਵਰੀ 'ਚ ਆਉਂਦਾ ਹੈ ਜੋ ਗੁਰੂ ਹੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਜੇ ਉਸ ਦਿਨਾਂ ਦੀ ਗੱਲ ਕਰੀਏ ਤਾਂ ਗੁਰਪੁਰਬ ਵੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਲੋਕ ਲੰਗਰ ਲਗਾਉਂਦੇ ਹਨ ਪਾਠ ਹੁੰਦੇ ਹੈ ਗੁਰਦੁਆਰੇ 'ਚ ਅਤੇ ਜਲਸਾ ਵੀ ਨਿਕਲਦਾ ਹੈ ਲੋਕ ਬੜਾ ਹੀ ਇੰਜੋਏ ਕਰਦੇ ਹੈ ਬੜੇ ਹੀ ਉਤਸ਼ਾਹ ਨਾਲ ਸਭ ਮਨਾਇਆ ਜਾਂਦਾ ਹੈ ਅਤੇ ਜੇ ਮੈਂ ਹੋਰ ਈਦ ਵਗੈਰਾ ਦੀ ਗੱਲ ਕਰਾਂ ਤਾਂ ਜਿਹੜੇ ਮੁਸਲਮਾਨ ਹੈ ਉਹ ਬੜੇ ਹੀ ਚੰਗੇ ਵੇਅ ਨਾਲ ਈਦ ਮਨਾਉਂਦੇ ਹਨ ਈਦ ਵੀ ਦੋ ਦੋ ਪ੍ਰਕਾਰ ਦੀ ਆਉਂਦੀ ਹੈ ਅਤੇ ਲੋਕ ਸੇਮੀਆਂ ਬਣਾਉਂਦੇ ਹਨ ਇੱਕ ਦੂਜੇ ਦੇ ਘਰ ਜਾਂਦੇ ਹਨ ਅਤੇ ਈਦ ਨੂੰ ਬੜਾ ਹੀ ਵਧੀਆ ਤਰ੍ਹਾਂ ਮਨਾਇਆ ਜਾਂਦਾ ਹੈ ਤੀਹ ਰੋਜੇ ਰੱਖੇ ਜਾਂਦੇ ਆ ਅਤੇ ਜਿਸ ਦਿਨ ਵੀ ਬੜਾ ਹੀ ਸ਼ਾਮ ਨੂੰ ਬੜੀ ਰੌਣਕ ਹੁੰਦੀ ਹੈ ਜਿਸ ਦਿਨ ਲੋਕ ਇੱਕ ਦੂਸਰੇ ਨੂੰ ਬੜਾ ਵਧੀਆ ਤਰ੍ਹਾਂ ਮਨਾਂਦੇ ਹਨ ਥੈਂਕ ਯੂ